ਮੈਨੂੰ ਖੇਡਣਾ ਪੜ੍ਹਨਾ ਅਤੇ ਘੁੰਮਣਾ ਫਿਰਨਾ ਪਸੰਦ ਹੈ ਅਤੇ ਮੈਂ ਰਨਿੰਗ ਸੁਬਾਹ ਉੱਠ ਕੇ ਰਨਿੰਗ ਕਰਦਾਂ ਅਤੇ ਸ਼ਾਮੀ ਕਸਰਤ ਵੀ ਕਰਦਾਂ ਮੈਂ ਸਕੂਲ ਤੋਂ ਬਚਪਨ ਤੋਂ ਹੀ ਰਨਿੰਗ ਕਰਦਾ ਆ ਰਿਹਾ ਮੈਂ ਸਕੂਲ ਵਿੱਚ ਐੱਨ ਸੀ ਸੀ ਰੱਖੀ ਜਿਸ ਨਾਲ਼ ਮੈਂ ਆਪਣੀ ਫਿਟਨੈੱਸ ਅਤੇ ਪੜ੍ਹਾਈ ਵੱਲ੍ਹ ਧਿਆਨ ਦਿੱਤਾ ਅਤੇ ਪੜ੍ਹਾਈ ਵਿੱਚ ਮੈਂ ਬਹੁਤ ਹੀ ਵਧੀਆ ਅੰਕ ਪ੍ਰਾਪਤ ਕੀਤੇ ਅਤੇ ਟੀਚਰ ਮੇਰੀ ਹਰ ਵੇਲ਼ੇ ਪ੍ਰਸੰਸਾ ਕਰਦੇ ਅਤੇ ਮੈਨੂੰ ਹਰੇਕ ਕੌਅਚਨ ਵੇਲ਼ੇ ਖੜ੍ਹਾ ਕਰਦੇ ਅਤੇ ਮੈਥੋਂ ਕੌਅਚਨ ਪੁੱਛਦੇ ਅਤੇ ਮੈਂ ਨਾਲ਼ ਹੀ ਨਾਲ਼ ਖੇਡਦਾ ਵੀ ਅਤੇ ਘੁੰਮਦਾ ਫਿਰਦਾ ਵੀ ਸੀ ਅਤੇ ਮੇਰੇ ਉੱਥੇ ਬਹੁਤ ਸਾਰੇ ਮਿੱਤਰ ਬਣੇ ਮੈਂ ਆਪਣੇ ਮਿੱਤਰਾਂ ਨਾਲ਼ ਘੁੰਮਦਾ ਫਿਰਦਾ ਅਤੇ ਸ਼ਹਿਰ ਵਿੱਚ ਘੁੰਮਦਾ ਅਤੇ ਸਿਨਮਾ ਦੇਖਣ ਅਤੇ ਹੋਰ ਤੀਰਥ ਅਸਥਾਨਾਂ ਜਿਵੇਂ ਕਿ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਘੁੰਮਣ ਜਾਂਦਾ ਅਤੇ ਉੱਥੇ ਗੁਰੂ ਦਰਸ਼ਨ ਕਰਦਾ ਅਤੇ ਮੈਂ ਹੋਰ ਜਿਵੇਂ ਕਿ ਪਾਰਕਾਂ ਮੈਨੂੰ ਫੁੱਟਵਾਲ ਖੇਡਣਾ ਵੀ ਪਸੰਦ ਹੈ ਮੈਂ ਫੁੱਟਵਾਲ ਆਪਣੇ ਦੋਸਤਰਾਂ ਮਿੱਤਰਾਂ ਨਾਲ਼ ਖੇਡਦਾ ਅਤੇ ਹੋਰ ਟੂਰਨਾਮੈਂਟ ਹੁੰਦੇ ਅਤੇ ਟੂਰਨਾਮੈਂਟ ਅਸੀਂ ਭਾਗ ਲੈਣਾ ਅਤੇ ਉਸ ਵਿੱਚ ਆਪਣਾ ਪੂਰਾ ਜ਼ੋਰ ਲਾ ਦੇਣਾ ਅਤੇ ਕੋਲਜ ਵਿੱਚ ਵੀ ਮੈਂ ਜਾ ਕੇ ਪੜ੍ਹਾਈ ਕੀਤੀ ਅਤੇ ਉੱਥੇ ਵੀ ਮੈਂ ਗੇਮਾਂ ਅਤੇ ਸਪੋਟਸ ਵਗੈਰਾ ਉਨ੍ਹਾਂ ਵਿੱਚ ਭਾਗ ਲਿਆ ਹੋਰ ਫੰਕਸ਼ਨ ਈਵੈਂਟਸ ਕੋਲਜ ਵਾਲੇ ਕਰਦੇ ਸੀ ਅਤੇ ਉਸ ਵਿੱਚ ਭਾਗ ਲੈਣਾ ਅਤੇ ਟੀਚਰਾਂ ਨਾਲ਼ ਅਤੇ ਹੋਰ ਦੋਸਤਾਂ ਮਿੱਤਰਾਂ ਨਾਲ਼ ਨਵਿਆਂ ਨਾਲ਼ ਜਾਣ ਪਛਾਣ ਕਰਨੀ ਅਤੇ ਉਹਨਾਂ ਨਾਲ਼ ਘੁੰਮਣਾ ਫਿਰਨਾ ਅਤੇ ਕਈ ਥਾਵਾਂ 'ਤੇ ਘੁੰਮਣਾ ਕਿਉਂਕਿ ਮੈਂ ਖੇਡਣਾ ਅਤੇ ਇਤਿਹਾਸਿਕ ਖੇਡਾਂ ਇਤਿਹਾਸ ਮੈਂ ਵੱਡਾ ਹੋ ਕੇ ਪੜ੍ਹਾਈ ਕਰਕੇ ਅਫ਼ਸਰ ਬਣਨਾ ਚਾਹੁੰਦਾ ਹਾਂ ਅਤੇ ਅਫ਼ਸਰ ਬਣ ਕੇ ਮੈਂ ਆਪਣੇ ਪਿੰਡ ਅਤੇ ਸ਼ਹਿਰ ਦਾ ਸੁਧਾਰ ਕਰਦਾ ਚਾਹੁੰਦਾ ਹਾਂ ਅਤੇ ਮੈਨੂੰ ਪੜ੍ਹਨਾ ਅਤੇ ਲਿਖਣਾ ਬਹੁਤ ਹੀ ਪਸੰਦ ਹੈ ਅਤੇ ਮੈਨੂੰ ਗਾਉਣਾ ਵੀ ਪਸੰਦ ਹੈ